ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਦੇ ਤਕਨੀਕੀ ਯੁੱਗ ਵਿੱਚ ਸਮਾਰਟ ਫੋਨ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵੱਧ ਕੀਚੇ ਜਾ ਰਹੀ ਹੈ ਤੀ ਕੀ ਸਮਾਰਟ ਫੋਨ ਤੋਂ ਬਿਨਾਂ ਲੋਕ ਰਹਿ ਨਹੀਂ ਸਕਦੇ ਹੈਗੇ ਉਹਨਾਂ ਨੂੰ ਸਮਾਰਟ ਫੋਨ ਦੀ ਇੰਨੀ ਆਦਤ ਹੋ ਗਈ ਹੈ ਕਿ ਉਹਨਾਂ ਨੂੰ ਉਸ ਸਮਾਰਟ ਫੋਨ ਤੋਂ ਬਿਨਾਂ ਰਹਿਣਾ ਬਹੁਤ ਹੀ ਮੁਸ਼ਕਿਲ ਲੱਗਦਾ ਹੈ ਉਹਨਾਂ ਦੇ ਲਈ ਇੱਦਾਂ ਹੈ ਆ ਜਿੱਦਾਂ ਸਮਾਰਟ ਫੋਨ ਤੋਂ ਬਿਨਾਂ ਉਹ ਜਿਉਂਦੇ ਹੀ ਨਹੀਂ ਰਹਿ ਸਕਦੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਮੇਰੇ ਕੋਲ ਪੁਰਾਣਾ ਫੋਨ ਹੁੰਦਾ ਸੀਗਾ ਉਹ ਨੋਕੀਆ ਦਾ ਫੋਨ ਹੁੰਦਾ ਸੀਗਾ ਤਾਂ ਉਹਦੇ ਬਟਨਾਂ ਵਾਲਾ ਫੋਨ ਉੱਦੋਂ ਉਹਨੂੰ ਕਹਿੰਦੇ ਹੁੰਦੇ ਸੀਗੇ ਅਤੇ ਅੱਜ ਕੱਲ੍ਹ ਟੱਚਸ ਫੋਨ ਚੱਲ ਗਏ ਹਨ ਜਿਹੜੇ ਕਿ ਜਿਹਨਾਂ ਦੀ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਲੋਕ ਵਰਤੋਂ ਕਰ ਰਹੇ ਹਨ ਕਿਉਂਕਿ ਉਹ ਉਹਨਾਂ ਨੂੰ ਬਟਨਾਂ ਵਾਲੇ ਫੋਨ ਤੋਂ ਜ਼ਿਆਦਾ ਮਤਲਬ ਕਿ ਹੈਲਪਫੁੱਲ ਸਮਝਦੇ ਹਨ ਕਿ ਸਾਨੂੰ ਜੇ ਅਸੀਂ ਸਮਾਰਟਫੋਨ ਯੂਜ਼ ਕਰੀਏ ਤਾਂ ਅਸੀਂ ਬਹੁਤ ਸਾਰਾ ਕੰਮ ਜਿਹੜਾ ਹੈਗਾ ਉਹ ਛੇਤੀ ਤੋਂ ਛੇਤੀ ਕਰ ਸਕਦੇ ਹੈਗੇ ਹਾਂ ਜੇ ਅਸੀਂ ਬਟਨਾਂ ਵਾਲੇ ਫੋਨ ਦੀ ਗੱਲ ਕਰੀਏ ਤਾਂ ਉਹਦੇ 'ਤੇ ਅਸੀਂ ਸਿਰਫ ਐੱਸ ਐੱਮ ਐੱਸ ਅਤੇ ਕੋਲ ਹੀ ਕਰ ਸਕਦੇ ਸੀਗੇ ਇਸ ਤੋਂ ਇਲਾਵਾ ਅਸੀਂ ਹੋਰ ਉਸ ਤੋਂ ਕੋਈ ਹੋਰ ਇਨਫੋਰਮੇਸ਼ਨ ਨਹੀਂ ਸ਼ੇਅਰ ਕਰ ਸਕਦੇ ਸੀ ਕਿ ਦੂਸਰੇ ਪਰਸਨ ਦੇ ਨਾਲ ਜੇ ਅਸੀਂ ਸਮਾਰਟਫੋਨ ਦੇ ਨਾਲ ਉਹਨੂੰ ਕੰਪੇਅਰ ਕਰੀਏ ਤਾਂ ਸਮਾਰਟਫੋਨ ਹੀ ਬਹੁਤ ਹੀ ਵਧੀਆ ਫੋਨ ਹੈ ਇਸ ਦੇ ਨਾਲ ਅਸੀਂ ਇੱਕ ਦੂਸਰੇ ਦੇ ਨਾਲ ਗੱਲ ਵੀ ਕਰ ਸਕਦੇ ਹੈਗੇ ਵੀਡੀਓ ਕੋਲ ਵੀ ਕਰ ਸਕਦੇ ਹਾਂ ਆਡੀਓ ਕੋਲ ਵੀ ਕਰ ਸਕਦੇ ਹੈਗੇ ਹਾਂ ਅਤੇ ਬਹੁਤ ਹੀ ਸਾਰੀਆਂ ਫੋਟੋਆਂ ਅਸੀਂ ਇੱਕ ਟਾਈਮ 'ਤੇ ਸੈਂਡ ਵੀ ਕਰ ਸਕਦੇ ਹੈ ਜੋ ਕਿ ਅਸੀਂ ਆਪਣੇ ਪੁਰਾਣੇ ਫੋਨ ਦੇ ਵਿੱਚ ਨਹੀਂ ਕਰ ਸਕਦੇ ਸੀਗੇ ਇਸ ਤਰ੍ਹਾਂ ਜਿਹੜਾ ਮੇਰਾ ਪੁਰਾਣਾ ਫੋਨ ਸੀਗਾ ਉਹ ਬਹੁਤ ਹੀ ਮਤਲਬ ਕਿ ਉਹਦੇ ਵਿੱਚ ਸਿਰਫ ਮੈਂ ਆਪਣੀ ਗੱਲ ਹੀ ਕਰ ਸਕਦੀ ਸੀਗੀ ਇਸ ਤੋਂ ਇਲਾਵਾ ਮੈਂ ਹੋਰ ਉਹਦੇ ਵਿੱਚ ਕੁਛ ਨਹੀਂ ਕਰ ਸਕਦੀ ਸੀਗੀ ਅਤੇ ਜੇ ਅਸੀਂ ਉਹਨੂੰ ਸਮਾਰਟਫੋਨ ਦੇ ਨਾਲ ਕੰਪੇਅਰ ਕਰੀਏ ਤਾਂ ਸਮਾਰਟ ਫੋਨ ਦੇ ਵਿੱਚ ਅਸੀਂ ਗੱਲ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਕੀ ਆ ਉਹ ਦੂਸਰੇ ਲੋਕਾਂ ਦੇ ਨਾਲ ਸ਼ੇਅਰ ਕਰ ਸਕਦੇ ਹਾਂ